ਪੰਜਾਬ ਦੇ ਲੋਕ ਬੋਲਦੇ ਹੀ ਹਨ ਪੰਜਾਬੀ ਅਤੇ ਉਹ ਆਪਣੇ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਸਭ ਤੋਂ ਜ਼ਿਆਦਾ ਆਪਣੇ ਰਿਸ਼ਤੇਦਾਰਾਂ ਨਾਲ ਪੰਜਾਬੀ ਦੀ ਹੀ ਵਰਤੋਂ ਕਰਦੇ ਹਨ ਕਿਉਂਕਿ ਉਹਨਾਂ ਦੀ ਪੰਜਾਬੀ ਮਾਂ ਬੋਲੀ ਹੈ ਜੋ ਕਿ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਨਾਲ ਸਾਨੂੰ ਬਹੁਤ ਪਿਆਰ ਹੈ ਸਾਨੂੰ ਆਪਣੀ ਪੰਜਾਬੀ ਬੋਲੀ 'ਤੇ ਬਹੁਤ ਗਰਵ ਹੈ ਮੈਨੂੰ ਤਾਂ ਸਪੈਸ਼ ਮੈਨੂੰ ਤਾਂ ਖਾਸ ਕਰਕੇ ਆਪਣੀ ਪੰਜਾਬੀ ਬੋਲੀ 'ਤੇ ਬਹੁਤ ਮਾਨ ਹੈ ਮੈਂ ਤਾਂ ਆਪਣੇ ਕਿਸੇ ਵੀ ਰਿਸ਼ਤੇਦਾਰਾਂ ਦੇ ਘਰ ਜਾਣਾ ਹੁੰਦਾ ਹੈ ਅਤੇ ਮੈਂ ਉਹਨਾਂ ਨਾਲ ਪੰਜਾਬੀ ਪਿਓਰ ਸ਼ੁੱਧ ਇੱਕਦਮ ਪੰਜਾਬੀ 'ਚ ਹੀ ਗੱਲ ਕਰਦੀ ਹਾਂ ਮੈਂ ਪੰਜਾਬੀ ਤੋਂ ਬਿਨਾਂ ਨਾ ਹਿੰਦੀ ਨਾ ਅੰਗਰੇਜ਼ੀ 'ਚ ਉਹਨਾਂ ਨਾਲ ਗੱਲ ਕਰਦੀ ਹਾਂ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਇਸ ਨਾਲ ਮਤਲਬ ਇਸ ਨਾਲ ਪੰਜਾਬੀ ਨਾਲ ਸਾਨੂੰ ਮਤਲਬ ਪੰਜਾਬੀ ਸਾਡੀ ਮਾਵਾਂ ਨੇ ਸਾਨੂੰ ਬਚਪਨ ਤੋਂ ਹੀ ਸਿਖਾਈ ਹੋਈ ਹੈ ਕਿ ਤੁਸੀਂ ਪੰਜਾਬੀ ਕਿੱਦਾਂ ਬੋਲਣੀ ਹੈ ਇਹ ਸਾਡੀ ਦਿਲੋਂ ਬੋਲਣ ਵਾਲੀ ਭਾਸ਼ਾ ਹੈ ਆਪਾਂ ਇਹ ਜੁਬਾਨ ਤੋਂ ਘਰ ਅਤੇ ਸਾਡੇ ਭਾਵ ਇਹਦੇ ਨਾਲ ਜ਼ਿਆਦਾ ਚੰਗੀ ਤਰ੍ਹਾਂ ਪ੍ਰਗਟ ਹੁੰਦੇ ਹਨ ਪੰਜਾਬੀ ਸਾਡੀ ਇੰਨੀ ਕੁ ਖਾਸ ਕੁ ਭਾਸ਼ਾ ਹੈ ਨਾ ਜਿਹਦੇ ਨਾਲ ਅਸੀਂ ਜਿਹਦੇ ਨਾਲ ਅਸੀਂ ਆਪਣੇ ਸਾਰੇ ਭਾਵ ਆਪਣੇ ਮਨ ਦੇ ਵਿਚਾਰ ਪ੍ਰਗਟ ਕਰਦੇ ਹਨ ਦੂਜਿਆਂ ਰਾਹੀਂ ਇਹ ਸਾਡੇ ਦਿਲ ਤੋਂ ਨਿਕਲਣ ਵਾਲੀ ਇੱਕ ਆਵਾਜ਼ ਹੀ ਹੁੰਦੀ ਹੈ ਇੱਦਾਂ ਹੀ ਸਮਝ ਲਓ ਪੰਜਾਬੀ ਸਾਡੀ ਮਾਂ ਬੋਲੀ ਹੈ